ਹਾਂਜੀ ਅਸੀਂ ਸਕੂਲ ਦੇ ਵਿੱਚ ਪ੍ਰੇਂਟਿੰਗ ਬਣਾਉਣੀ ਸਿੱਖੀ ਸੀ ਸਾਡੇ ਪੇਂਟਿੰਗ ਵਾਲੇ ਸਰ ਨੇ ਸਾਨੂੰ ਸਟਾਰਟਿੰਗ ਤੋਂ ਪੇਂਟਿੰਗ ਕਰਨੀ ਸਿਖਾਈ ਉਹਨਾਂ ਨੇ ਸਾਨੂੰ ਪਹਿਲਾਂ ਲਾਈਨਾਂ ਮਾਰਨੀਆਂ ਸਿਖਾਈਆਂ ਅਸੀਂ ਲਾਈਨਾਂ ਮਾਰੀਆ ਫਿਰ ਉਹਨਾਂ ਨੇ ਸਾਨੂੰ ਅਲੱਗ ਅਲੱਗ ਪ੍ਰਕਾਰ ਦੇ ਫਲਾਵਰ ਬਣਾਉਣ ਲਈ ਬਣਾਉਣਾ ਸਿਖਾਇਆ ਵੱਖ ਵੱਖ ਪ੍ਰਕਾਰ ਦੇ ਫਲਾਵਰ ਬਣਾਉਣੇ ਸਿਖਾਏ ਸ਼ੇਪਸ ਦਿੱਤੀਆਂ ਫਿਰ ਉਹਨਾਂ ਨੇ ਸਾਨੂੰ ਇੱਕ ਬੋਕਸ ਬਣਾ ਸਾਨੂੰ ਉਹਨੇ ਬੋਕਸ ਬਣਾ ਕੇ ਉਸ ਦੇ ਵਿੱਚ ਪਸ਼ੂ ਪੰਛੀ ਜਾਨਵਰਾਂ ਦੀਆਂ ਤਸਵੀਰਾਂ ਬਣਾਉਣੀਆਂ ਸਿਖਾਈਆਂ ਫਿਰ ਸਾਨੂੰ ਉਹਨਾਂ ਦੇ ਵਿੱਚ ਵੱਖ ਵੱਖ ਪ੍ਰਕਾਰ ਦੇ ਰੰਗ ਭਰਨੇ ਸਿਖਾਏ ਇਸ ਤਰ੍ਹਾਂ ਸਾਨੂੰ ਹੌਲੀ ਹੌਲੀ ਪੇਂਟਿੰਗ ਕਰਨੀ ਆ ਗਈ ਅਤੇ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਪੇਂਟਿੰਗ ਕਰ ਲੈਂਦੇ ਹਾਂ